ਸਾਡੇ ਜ਼ਿਲ੍ਹੇ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਹੈ ਜਿੱਥੇ ਕਿ ਲੋ ਅ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਹਨ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਪੈਰਾਂ ਦੇ ਪੈੜ ਛਾਪੇ ਹੋਏ ਹਨ ਜਿੱਥੇ ਕਿ ਲੋਕ ਮੱਥਾ ਟੇਕਦੇ ਹਨ ਅਤੇ ਦੂਰੋਂ ਦੂਰੋਂ ਹਰੇਕ ਭਾਈਚਾਰੇ ਦੇ ਲੋਕ ਹਰੇਕ ਸਮਾਜ ਦੇ ਲੋਕ ਇੱਥੇ ਨਮਨ ਕਰਨ ਆਉਂਦੇ ਹਨ ਇੱਥੇ ਕੀ ਹੈ ਕਿ ਹਰ ਤਰ੍ਹਾਂ ਦੇ ਜਾਤੀ ਦੇ ਲੋਕ ਚਾਹੇ ਉਹ ਮੁਸਲਿਮ ਹਿੰਦੂ ਸਿੱਖ ਸਾਰੇ ਹੀ ਆਪਣਾ ਮੱਥਾ ਟੇਕਣ ਆਉਂਦੇ ਹਨ ਇੱਥੇ ਕੀ ਹੈ ਕਿ ਸਭ ਤੋਂ ਵੱਡਾ ਤਿਉਹਾਰ ਇੱਥੇ ਗੁਰਪੁਰਬ ਦੀਵਾਲੀ ਮਨਾਇਆ ਜਾਂਦਾ ਹੈ ਅਤੇ ਇੱਥੇ ਸ਼ਹੀਦੀ ਜੋੜ ਮੇਲਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਨ